ਭੰਗੜਾ ਇੱਕ ਬਹੁਤ ਵਧੀਆ ਕਸਰਤ ਹੈ ਇਹ ਮਨੋਰੰਜਨ ਦਾ ਸਾਧਨ ਵੀ ਹੈ ਇਹ ਬੱਚਿਆਂ ਨੂੰ ਬੜਾ ਪਸੰਦ ਹ ਅੱਜ ਕੱਲ ਦੇ ਵਿੱਚ ਅੱਜ ਕੱਲ ਬੱਚੇ ਜਿਆਦਾ ਭੰਗੜੇ ਵੱਲ ਧਿਆਨ ਦਿੰਦੇ ਹਨ ਵੱਡੇ ਵੀ ਧਿਆਨ ਦਿੰਦੇ ਹਨ ਵੱਡਿਆਂ ਦੀ ਵੀ ਇਹ ਕਸਰਤ ਦਾ ਤਰੀਕਾ ਹੈ ਤੇ ਇਸ ਨੂੰ ਸਾਰੇ ਪਸੰਦ ਕਰਦੇ ਨੇ ਸਾਰੇ ਨੌਜਵਾਨ ਸਾਰੇ ਬੁੱਢੇ ਬੱਚੇ ਸਭ ਪਸੰਦ ਕਰਦੇ ਨੇ ਭੰਗੜੇ ਨੂੰ ਭੰਗੜੇ ਨਾਲ ਸਰੀਰ ਠੀਕ ਰਹਿੰਦਾ ਹੈ ਸਿਹਤ ਠੀਕ ਰਹਿੰਦੀ ਹੈ ਭੰਗੜਾ ਇੱਕ ਸਿਹਤ ਦਾ ਅੱਛਾ ਤਰੀਕਾ ਹੈ ਸਿਹਤ ਚੰਗੀ ਕਰਨ ਦਾ ਅੱਛਾ ਤਰੀਕਾ ਹੈ ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਨਾਲੇ ਮਨੋਰੰਜਨ ਦਾ ਸਾਧਨ ਬਣਿਆ ਰਹਿੰਦਾ ਹੈ

ਇਹ ਇਹ ਹੁਣ ਸਾਰੇ ਸੰਸਾਰ ਵਿੱਚ ਸਾਰੇ ਪੰਜਾਬ ਵਿੱਚ ਫੈਲ ਗਿਆ ਹੈ ਸਾਰੇ ਭਾਰਤ ਵਿੱਚ ਫੈਲ ਗਿਆ ਹੈ ਜਿਹੜਾ ਕਿ ਲੋਕੀ ਬਹੁਤ ਚੰਗੀ ਤਰ੍ਹਾਂ ਇਸ ਨੂੰ ਜਾਣਕਾਰੀ ਨਾਲ ਕਰ ਰਹੇ ਹਨ ਤੇ ਇਸ ਇਸ ਭੰਗੜੇ ਦੀ ਵੱਧ ਤੋਂ ਵੱਧ ਲੋਕੀ ਹੁਣ ਧਿਆਨ ਦਿੰਦੇ ਹਨ ਬੱਚਿਆਂ ਨੂੰ ਵੀ ਸਿਖਾਣ ਨੂੰ ਤੇ ਵੱਡੀਆਂ ਵੱਡੇ ਵੀ ਨਾਲ ਬੱਚੇ ਬੱਚਿਆਂ ਦੇ ਨਾਲ ਕਰਦੇ ਹਨ ਭੰਗੜਾ ਪਾਉਂਦੇ ਹਨ ਤੇ ਇਹ ਭੰਗੜੇ ਜਿਹੜਾ ਇਹ ਇਸ ਇੱਕ ਦੁਨਿਆਵੀ ਬਣ ਗਿਆ ਤਰੀਕਾ ਬਣ ਗਿਆ ਹੈ ਘਰ ਘਰ ਵਿੱਚ ਘਰ ਘਰ ਵਿੱਚ ਇਹ ਭੰਗੜਾ ਪਾਂਦਾ ਹੁਣ ਸਾਧਨ ਸਾਧਨ ਬਣ ਗਿਆ ਹੈ ਕਿਉਂਕਿ ਲੋਕੀ ਇਸ ਨੂੰ ਬਹੁਤ ਅੱਛੀ ਤਰਾਂ ਕਰਦੇ ਹਨ ਇਹ ਇਹ ਜਿਹੜਾ ਤਰੀਕਾ ਹ ਇਸ ਸਿਹਤ ਨੂੰ ਫਿੱਟ ਰੱਖਣ ਦਾ ਤਰੀਕਾ ਹੈ ਇਹ ਬੱਚਿਆਂ ਨੂੰ ਵੀ ਵੱਧਣ ਫੁੱਲਣ ਦਾ ਇੱਕ ਸਾਧਨ ਬਣਿਆ ਹੋਇਆ ਹੈ ਇਹ ਖੁਸ਼ੀਆਂ ਲਾਂਦਾ ਸ ਸਰੀਰ ਨੂੰ ਇਹ ਖੁਸ਼ੀਆਂ ਲਿਆਂਦਾ ਹੈ ਸਰੀਰ ਨੂੰ ਬੱਚਿਆਂ ਦੇ ਤੇ ਇਹ ਹੁਣ